ਭਾਰਤੀ ਨੌਕਰੀ ਬਾਜ਼ਾਰ ਬਹੁਤ ਜ਼ਿਆਦਾ ਘੱਟ ਰਿਹਾ ਹੈ ਕਿਸੇ ਨੂੰ ਵੀ ਨੌਕਰੀਆਂ ਨਹੀਂ ਮਿਲ ਰਹੀਆਂ ਭਾਵੇਂ ਹੀ ਅਗਲੇ ਸਾਲ ਆਰਥਿਕ ਵਿਕਾਸ ਦੀ ਸੰਭਾਵਨਾ ਚੰਗੀ ਨਜ਼ਰ ਆ ਰਹੀ ਹੈ ਪਰ ਸਰਕਾਰ ਨੇ ਸਭ ਤੋਂ ਵੱਡੀ ਰੁਕਾਵਟ ਨੌਕਰੀਆਂ 'ਤੇ ਅਵਸਰ ਪੈਦਾ ਕਰਦੇ ਹਨ ਛੋਟੇ ਕਾਰੋਬਾਰੀ ਅਜੇ ਨਵੰਬਰ ਵਿੱਚ ਹੀ ਉਹਨਾਂ ਦੀ ਦੋ ਹਜ਼ਾਰ ਸੌਲ੍ਹਾਂ ਵਿੱਚ ਨੋਟਬੰਦੀ ਹੋਣ 'ਤੇ ਵੀ ਕਾਫੀ ਕੰਮ ਘੱਟ ਚੁੱਕਾ ਹੈ ਇਹਨਾਂ ਵਿੱਚ ਕਈ ਬੰਦ ਹੋ ਗਏ ਸਨ ਲੱਖਾਂ ਬੇਰੁਜ਼ਗਾਰ ਹੋ ਗਏ ਖਾਸ ਕਰਕੇ ਜੋ ਦਿਹਾੜੀਏ ਸੀ ਅਤੇ ਮਜ਼ਦੂਰ ਇਹਨਾਂ ਦੀ ਵੱਡੀ ਮਾਰ ਪਈ ਭਾਰਤੀ ਰੇਟਿੰਗ ਏਜੰਸੀ ਕੇਅਰ ਦੇ ਮੁੱਖ ਅਰਥਸ਼ਾਸਤਰੀ ਮਦਨ ਕਹਿੰਦੇ ਸੀ ਜੀ ਐੱਸ ਟੀ ਲਾਗੂ ਕੀਤੇ ਜਾਣ ਕਰਕੇ ਭਾਰਤ ਵਿੱਚ ਪਰਿਵਰਤਨ ਦਾ ਸ ਵੱਧ ਪਰਿਵਰਤਨ ਵੱਧ ਰਿਹਾ ਹੈ ਅਗਲੇ ਕੁਛ ਸਾਲਾਂ ਦੇ ਵਿਕਾਸ ਲਈ ਇਹ ਬਹੁਤ ਜ਼ਰੂਰੀ ਸੀ ਪ੍ਰਧਾਨ ਮੰਤਰੀ ਮੋਦੀ ਦਾ ਵੀ ਕਹਿਣਾ ਹੈ ਇਹ ਇੱਕ ਵੱਡੇ ਵੱਡੀ ਸਮੱਸਿਆ ਬਣੀ ਹੋਈ ਹੈ ਹਾਲਾਂਕਿ ਉਹ ਸਮਝਦੇ ਸੀ ਇਸ ਸਮੱਸਿਆ ਨੂੰ ਫਿਰ ਉਹਨਾਂ ਨੇ ਕਦਮ ਵੀ ਚੁੱਕੇ ਜਿ ਜਿਸ ਜਿਸ ਕਰਕੇ ਤੇਲ ਦੀ ਅਵਸਥਾ ਬਹੁਤ ਜ਼ਿਆਦਾ ਘੱਟ ਰਹੀ ਸੀ ਤੇਲ ਬਹੁਤ ਮਹਿੰਗਾ ਹੋ ਰਿਹਾ ਸੀ ਹੋਰ ਵੀ ਕਾਫੀ ਚੀਜ਼ਾਂ ਜੋ ਮਹਿੰਗੀਆਂ ਹੋ ਰਹੀਆਂ ਸੀ ਜਿਸ ਕਰਕੇ ਗਰੀਬਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਸੀ ਅਤੇ ਅਮੀਰਾਂ ਨੂੰ ਵੀ ਪੈਸੇ ਕੱਢਣੇ ਬਹੁਤ ਔਖੇ ਹੋ ਰਹੇ ਸਨ ਪਿਛਲੇ ਕੁਛ ਸਾਲਾਂ ਤੋਂ ਖੇਤੀ ਸੈਕਟਰ ਖੇਤੀ ਤੋਂ ਹੀ ਆਮਦਨੀ ਨੂੰ ਲੈ ਕੇ ਸੰਘਰਸ਼ ਕਰ ਰਿਹਾ ਹੈ ਅੱਧੀ ਤੋਂ ਜ਼ਿਆਦਾ ਭਾਰਤੀ ਆਬਾਦੀ ਖੇਤੀ 'ਤੇ ਨਿਰਭਰ ਹੈ ਜੋ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਉਹ ਸਾਰੇ ਉਹ ਸਾਰੇ ਖੇਤੀ 'ਤੇ ਨਿਰਭਰ ਹਨ ਇਸ ਦੌਰਾਨ ਲੱਖਾਂ ਲੋਕ ਕਰਜ਼ ਨਹੀਂ ਚੁਕਾ ਸਕੇ ਜਿਸ ਨਾਲ ਪਰੇਸ਼ਾਨੀਆਂ ਵਧੀਆਂ ਹਨ ਕੁਝ ਸੂਬੇ ਜਿਵੇਂ ਕਿ ਯੂਪੀ ਮਹਾਰਾਸ਼ਟਰਾ ਵਿੱਚ ਉਹਨਾਂ ਉੱਥੇ ਕਿਸਾਨਾਂ ਲਈ ਕਰਜ਼ ਮਾਫ਼ੀ ਦਾ ਐਲਾਨ ਵੀ ਕੀਤਾ ਸੀ ਪਰ ਇਸ ਨੂੰ ਲਾਗੂ ਕਰਨ ਲਈ ਦਿੱਕਤਾਂ ਸਨ ਹੋਰ ਵੀ ਕਾਫੀ ਪ੍ਰੋਬਲਮਸ ਉਹਨਾਂ ਨੂੰ ਆਈਆਂ ਸੀ ਹਾਲਾਂਕਿ ਕੁਛ ਕਹਿਣ ਕਹਿ ਰਹੇ ਸੀ ਕਿ ਸੁਸਤ ਪਈ ਰਫ਼ਤਾਰ ਤੋਂ ਉੱਭਰਨਾ ਇੰਨਾ ਆਸਾਨ ਨਹੀਂ ਹੋਵੇਗਾ ਪਰ ਜ਼ਿਆਦਾਤਰ ਮਾਹਰ ਕਹਿੰਦੇ ਸਨ ਕਿ ਇਹ ਅਗ ਅਗਲੇ ਸਾਲਾਂ ਦੇ ਵਿੱਚ ਕੁਛ ਚੰ ਚੰਗੀ ਹੋਵੇਗੀ